ਸਾਡੇ ਪੰਜਾਬ ਵਿੱਚ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਗੁੜ ਵਾਲੇ ਚੌਲ ਮਿੱਠੀਆਂ ਰੋਟੀਆਂ ਗੁੜ ਵਾਲੀਆਂ ਅਤੇ ਜ਼ਿਆਦਾਤਰ ਬਣਾਉਂਦੇ ਹਨ ਇਹ ਮਿੱਠੀਆਂ ਰੋਟੀਆਂ ਐਂ ਮਿੱਠੀਆਂ ਰੋਟੀਆਂ ਅਤੇ ਗੁੜ ਵਾਲੇ ਚੌਲ ਸੌਖੇ ਤਰੀਕੇ ਨਾਲ ਅਤੇ ਵਧੀਆ ਬਣਾਏ ਜਾਂਦੇ ਹਨ ਅਤੇ ਗੁੜ ਵਾਲੀਆਂ ਗੁੜ ਵਾਲੀਆਂ ਮਿੱਠੀਆਂ ਰੋਟੀਆਂ ਅ ਆਟੇ ਵਿੱਚ ਗੁੜ ਗੁੜ ਨੂੰ ਭਿਓਂ ਕੇ ਔਰ ਉਸ ਗੁੜ ਵਾਲਾ ਆਟਾ ਗੁੰਨ ਗੁੰਨ ਕੇ ਉਹਦੇ ਵਿੱਚ ਉਹਨੂੰ ਤਿਆਰ ਕਰਕੇ ਔਰ ਮਿੱਠੀਆਂ ਰੋਟੀਆਂ ਬਣਾਈਆਂ ਜਾਂਦੀਆਂ ਹਨ ਅਤੇ ਗੁੜ ਵਾਲੇ ਚੌਲ ਵੀ ਵਧੀਆ ਵਧੀਆ ਐਂਡ ਸੌਖੇ ਤਰੀਕੇ ਨਾਲ ਬਣਦੇ ਹਨ ਅਤੇ ਖਾਣ ਵਿੱਚ ਵੀ ਵਧੀਆ ਟੇਸਟੀ ਹੁੰਦੇ ਹਨ ਅਤੇ ਸ ਪੰਜਾਬੀ ਲੋਕ ਪੰਜਾਬ ਪੰਜਾਬੀ ਲੋਕ ਆਪਣੇ ਘਰਾਂ ਵਿੱਚ ਜ਼ਿਆਦਾ ਮਿੱਠੀਆਂ ਰੋਟੀਆਂ ਬਣਾਉਂਦੇ ਹਨ ਐਂਡ ਪੰਜਾਬੀਆਂ ਦਾ ਫੇਮਸ ਸਰਦੀ ਸਰਦੀ ਵਿੱਚ ਬਣਾਉਣ ਵਾਲਾ ਫੇਮਸ ਸਾਗ ਅ ਸਰ ਸਰੋਂ ਦਾ ਸਾਗ ਸਰੋਂ ਦੇ ਸਾਗ ਨਾਲ ਮੱਖਣ

ਮੱਖ ਸਰੋਂ ਦਾ ਸਾਗ ਵੀ ਵਧੀਆ ਔਰ ਸੌਖੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਬਣਾਇਆ ਜਾਂਦਾ ਹੈ ਅਤੇ ਖਾਣ ਵਿੱਚ ਵੀ ਬਹੁਤ ਵਧੀਆ ਬਣਦਾ ਹੈ